ਘਰ ਵਿੱਚ ਪਕਾਉਣ ਲਈ ਮੈਨੂੰ ਵਧੀਆ ਪਕਵਾਨ ਛੋਲੇ ਪੂਰੀਆਂ ਲੱਗਦੇ ਨੇ ਕੋਈ ਠੰਡ ਦਾ ਮੌਸਮ ਹੋਵੇ ਜਾਂ ਕਿਸੇ ਰਿਸ਼ਤੇਦਾਰ ਨੇ ਆਉਣਾ ਹੋਵੇ ਤਾਂ ਵਧੀਆ ਲੱਗਦਾ ਕਿ ਅੱਜ ਛੋਲੇ ਪੂਰੀਆਂ ਬਣਾਉਗੇ ਬੜੇ ਹੀ ਮਜ਼ੇ ਦੇ ਨਾਲ ਸਾਰੇ ਖਾਂਦੇ ਹਾਂ ਅਤੇ ਬਣਾਉਂਦੇ ਹਾਂ